ਇੱਕ ਯਾਤਰੀ ਬੱਸ ਵਿੱਚ ਮੈਂ ਅਗਰ ਦੱਸਾਂ ਤਾਂ ਮੈਂ ਬੈਠੀ ਹਾਂ ਅਤੇ ਮੈਂ ਦ ਮੈਂ ਇੱਕ ਸਾਈਡ 'ਤੇ ਯਾਤਰੀ ਬੱਸ ਦੇ ਵਿੱਚ ਸੀਟ ਵੀ ਜੋ ਡਰਾਈਵਰ ਸੀਟ ਹੈ ਅਤੇ ਡਰਾਈਵਰ ਸੀਟ ਦੇ ਨਾਲ ਹੀ ਇੱਕ ਸਟੋਰੇਜ ਉਹਨਾਂ ਨੇ ਜਗ੍ਹਾ ਬਣਾਈ ਹੋਈ ਹੈ ਅਤੇ ਦੂਜੇ ਕੈਰੀਅਰ ਮਤਲਬ ਉੱਪਰ ਜੋ ਪੈਸੇਂਜਰ ਹਨ ਜੋ ਯਾਤਰੀ ਹਨ ਉਹ ਆਪਣਾ ਸਮਾਨ ਰੱਖਦੇ ਹਨ ਅਤੇ ਵਿੰਡੋਜ ਹੁੰਦੀਆਂ ਹਨ ਵ ਸੀਟ ਦੇ ਨਾਲ ਹੀ ਵਿੰਡੋਜ਼ ਹੁੰਦੀਆਂ ਹਨ ਜਿਹਦੇ ਵਿੱਚ ਕਿ ਜੋ ਯਾਤਰੀ ਹੁੰਦੇ ਹਨ ਉਹ ਆਪਣਾ ਮਤਲਬ ਮਤਲਬ ਹਵਾ ਪੀ ਕਰਦੇ ਆ ਹਵਾ ਮਤਲਬ ਆਉਂਦੀ ਹੈ ਅਤੇ ਆਪਣੇ ਆਪ ਨੂੰ ਥੋੜ੍ਹਾ ਕੰਫਰਟੇਬਲ ਫੀਲ ਕਰਦੇ ਹਨ ਅਤੇ ਡੀਜ਼ਲ ਇਹ ਇਹ ਜੋ ਬੱਸ ਹੈ ਡੀਜ਼ਲ 'ਤੇ ਕੰਮ ਕਰਦੀ ਅਤੇ ਮੈਂ ਇਸਦੀ ਯਾਤਰਾ ਆਪਣੇ ਕੋਲਜ ਤੋਂ ਆਪਣੇ ਜੋ ਕੋਲਜ ਹੈ ਮੇਰਾ ਉਸ ਤੋਂ ਮੈਂ ਇੱਕ ਟੂਰ ਦੇ ਵਜੋਂ ਇੱਕ ਯਾਤਰਾ ਕੀਤੀ ਜਿਸ ਅਤੇ ਕਿ ਅਸੀਂ ਅੰਮ੍ਰਿਤਸਰ ਤੋਂ ਮਿਨੀ ਗੋਆ ਤੱਕ ਗਏ